ਵੈਸੇ ਤਾਂ ਸਾਡੇ ਘਰ ਸਰਕਾਰੀ ਪਾਣੀ ਵੀ ਆਉਂਦਾ ਅਤੇ ਉਸ ਨੂੰ ਪਾਣੀ ਨੂੰ ਫਿਲਟਰ ਕਰਨ ਲਈ ਆਰ ਓ ਵੀ ਹੈ ਬਟ ਫਿਰ ਵੀ ਜੇ ਸਾਨੂੰ ਲੱਗੇ ਸਾਡਾ ਫਿਲਟਰ ਕੰਮ ਨਈ ਕਰ ਰਿਹਾ ਆਰ ਓ ਵਰਕ ਨਹੀਂ ਕਰ ਰਿਹਾ ਤਾਂ ਉਸ ਦੇ ਲਈ ਅਸੀਂ ਗੈਸ ਦੀ ਵਰਤੋਂ ਕਰਦੇ ਹਾਂ ਗੈਸ 'ਤੇ ਪਾਣੀ ਰੱਖ ਕੇ ਉਸਨੂੰ ਬੋਇਲ ਕਰਦੇ ਹਾਂ ਜਿਸ ਨਾਲ ਪਾਣੀ ਫਿਲਟਰ ਹੋ ਜਾਂਦਾ ਜੇ ਫਿਰ ਵੀ ਇਨ ਕੋਈ ਇਮਪੇਰੀਟੀਜ਼ ਰਹਿ ਜਾਂਦੀਆਂ ਨੇ ਤਾਂ ਉਸ ਨੂੰ ਅਸੀਂ ਅਗੇਨ ਦੁਬਾਰਾ ਤੋਂ ਬੋਇਲ ਕਰਕੇ ਫਿਲਟਰ ਕਰਦੇ ਹਾਂ ਅਤੇ ਉਸ ਨਾਲ ਪਾਣੀ ਪੁਣ ਲੈਂਦੇ ਹਾਂ ਤਾਂ ਉਹਦੇ ਨਾਲ ਪਾਣੀ ਪਿਓਰ ਹੋ ਜਾਂਦਾ ਹੈ